ਹਾਂ ਮੈਂ ਤੋਹਫ਼ੇ ਵਿੱਚ ਕਾਰਡ ਦਿੱਤਾ ਸੀ ਮੈਨੂੰ ਚਿੱਤਰਕਲਾ ਦਾ ਬਹੁਤ ਸ਼ੌਂਕ ਹੈ ਮੈਂ ਬਚਪਨ ਵਿੱਚ ਹੀ ਇਹ ਕਲਾ ਦਾ ਪ੍ਰਯੋਗ ਕਰਦੀ ਆਈ ਹਾਂ ਮੈਂ ਚਿੱਤਰਕਲਾ ਤੋਂ ਇਲਾਵਾ ਸੂਟ ਪੇਂਟ ਕੰਧਾਂ 'ਤੇ ਪੇਂਟ ਸੀਨਰੀਆਂ ਆਦਿ ਬਣਾ ਲੈਂਦੀ ਹਾਂ ਇੱਕ ਵਾਰ ਮੇਰੀ ਸਹੇਲੀ ਦਾ ਜਨਮਦਿਨ ਸੀ ਮੈਂ ਉਸ ਨੂੰ ਮੈਂ ਆਪਣੇ ਹੱਥੀ ਚਿੱਤਰਕਾਰੀ ਕਰਕੇ ਇੱਕ ਕਾਰਡ ਬਣਾ ਕੇ ਦਿੱਤਾ ਸੀ ਇਸ ਕਾਰਡ ਵਿੱਚ ਮੈਂ ਉਹਨਾਂ ਦੇ ਸਾਰੇ ਪਰਿਵਾਰ ਦੀਆਂ ਤਸਵੀਰਾਂ ਬਣਾਈਆਂ ਸਨ ਉਹ ਤਸਵੀਰਾਂ ਸਾਰਿਆਂ ਨੂੰ ਬਹੁਤ ਪਸੰਦ ਆਈਆਂ ਉਸ ਵਿੱਚ ਮੈਂ ਬਹੁਤ ਸਾਰੇ ਰੰਗ ਅਤੇ ਪਿਆਰ ਵਰਤਿਆ ਸੀ ਹੱਥ ਨਾਲ ਅਸੀਂ ਜੋ ਵੀ ਤਸਵੀਰ ਜਾਂ ਚਿੱਤਰਕਾਰੀ ਕਰਦੇ ਹਾਂ ਉਸ ਵਿੱਚ ਅਸੀਂ ਪੂਰੀ ਮਿਹਨਤ ਲਗਾਉਂਦੇ ਹਾਂ ਉਸ ਵਿੱਚ ਅਸੀਂ ਬਹੁਤ ਸਾਰਾ ਪਿਆਰ ਵੀ ਪਾਉਂਦੇ ਹਾਂ ਜਿਸ ਨਾਲ ਹੀ ਹੱਥ ਦੀ ਬਣੀ ਹੋਈ ਤਸਵੀਰ ਜਾਂ ਕੋਈ ਵੀ ਪੇਂਟਿੰਗ ਪਸੰਦ ਆਉਂਦੀ ਹੈ ਇਸ ਵਿੱਚ ਸਾਡੇ ਮੋਹ ਦੀਆਂ ਤੰਦਾਂ ਨੂੰ ਸਿਰਜਿਆ ਜਾਂਦਾ ਹੈ ਇਹ ਭਾਵਨਾਵਾਂ ਨਾਲ ਜੁੜੀਆਂ ਹੁੰਦੀਆਂ ਹਨ